ਮੈਂ ਪ੍ਰੈਸ ਦੀ ਆਜ਼ਾਦੀ ਬਾਰੇ ਇਹ ਸੋਚਦਾ ਹਾਂ ਕਿ ਪ੍ਰੈਸ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ ਹੈ

ਪ੍ਰੈੱਸ ਸਹੀ ਵੀ ਆ ਕਈ ਜਗ੍ਹਾਵਾਂ 'ਤੇ ਪ੍ਰੈਸ ਸਹੀ ਵੀ ਹੈ ਅਤੇ ਗਲਤ ਵੀ ਹੈ ਇਸ ਗੱਲ ਦਾ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਪ੍ਰੈਸ ਕਈਆਂ ਥਾਵਾਂ 'ਤੇ ਗਲਤ ਹੋ ਜਾਂਦੀ ਹੈ ਵੱਧ ਤੋਂ ਵੱਧ ਆਪਾਂ ਵੇਖਿਆ ਹੈ ਕਿ ਪ੍ਰੈਸ ਜਿ ਜ਼ਿਆਦਾਤਰ ਥਾਵਾਂ 'ਤੇ ਗਲਤ ਹੈ ਲੂਣ ਮਿਰਚ ਮਸਾਲੇ ਜ਼ਿਆਦਾ ਲਗਾਉਂਦੀ ਹੈ ਪ੍ਰੈਸ ਸੋ ਇਸ ਦੇ ਫਾਇਦੇ ਇਹ ਹਨ ਕਿ ਇਸ ਤੋਂ ਸਾਨੂੰ ਬਾਜ਼ਾਰ ਵਿੱਚ ਵੱਧ ਰਹੇ ਦਾਮਾਂ ਦਾ ਜਾਂ ਮੰਡੀ ਦਾ ਜਾਂ ਕਿਸੇ ਵੀ ਹੋਰ ਚੀਜ਼ ਦਾ ਪਤਾ ਲੱਗਦਾ ਰਹਿੰਦਾ ਹੈ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਕਿੱਥੇ ਕਿਹੜੀ ਜਗ੍ਹਾ 'ਤੇ ਕੀ ਹੋ ਰਿਹਾ ਕਿਹੜੇ ਦੇਸ਼ 'ਚ ਕੀ ਹੋ ਰਿਹਾ ਇਸ ਇਸ ਤੋਂ ਸਾਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਪ੍ਰੈਸ ਤੋਂ ਅਸੀਂ ਟੀ ਵੀ 'ਤੇ ਰੋਜ਼ਾਨਾ ਖਬਰਾਂ ਸਵੇਰੇ ਲਾਸ ਲਾ ਕੇ ਦੇਖ ਸਕਦੇ ਹਾਂ ਇਹ ਪ੍ਰੈਸ ਦਾ ਬਹੁਤ ਵੱਡਾ ਬੈਨੀਫਿਟ ਹੈ ਸਾਨੂੰ ਇਸ ਤੋਂ ਬਾਅਦ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਕਿਸੇ ਵੀ ਖਬਰ ਨੂੰ ਵਧਾ ਚੜ੍ਹਾ ਕੇ ਬਹੁਤ ਦੱਸਦੇ ਹਨ ਸਰਕਾਰਾਂ ਬਾਰੇ ਹੋ ਗਿਆ ਸਪੋਰਟਸ ਬਾਰੇ ਹੋ ਗਿਆ ਕਿਸੇ ਨੇ ਵੀ ਕੋਈ ਵੀ ਚੀਜ਼ ਕਰ ਦਿੱ ਕਰ ਦਿੱਤੀ ਖੇਡ ਵਿੱਚ ਇਸ ਨੂੰ ਵਧਾ ਚੜ੍ਹਾ ਕੇ ਦੱਸਣਾ ਕਿ ਇਸ ਪਲੇਅਰ ਨੇ ਇਹ ਕੀਤਾ ਉਸਨੂੰ ਦੂਸਰੀ ਤੀਸਰੀ ਮੰਜ਼ਿਲ 'ਤੇ ਲੈ ਜਾਣਾ ਗੱਲ ਨੂੰ ਉਹ ਉਹਦੀ ਗੱਲ ਨੂੰ ਕਈ ਖਬਰਾਂ ਜੈਨੀਉਨ ਵੀ ਹੁੰਦੀਆਂ ਹਨ ਜਿਵੇਂ ਸਾਨੂੰ ਬਹੁਤ ਹੀ ਵਧੀਆ ਸੰਦੇਸ਼ ਦਿ ਦਿੱਤੇ ਜਾਂਦੇ ਹਨ ਜਿਵੇਂ ਬਹੁਤ ਬੱਚੇ ਸਫਲਤਾਵਾਂ ਪ੍ਰਾਪਤ ਕਰਦੇ ਹਨ ਮੈਡਲ ਲੈਂਦੇ ਹਨ ਇਸ ਨਾਲ ਸਾਨੂੰ ਵੀ ਜਾਗਰੂਕਤਾ ਆਉਂਦੀ ਹੈ ਸਾਡੇ ਵਿੱਚ ਕਿ ਆਪਾਂ ਵੀ ਇੱਦਾਂ ਕਰਨ ਦੀ ਕੋਸ਼ਿਸ਼ ਕਰੀਏ ਇਸ ਤੋਂ ਬਾਅਦ ਇਹਨਾਂ ਤੋਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਸਿਮ ਆਈ ਹੈ ਅਤੇ ਕਿਹੜੀ ਸਿਮ ਨਹੀਂ ਆਈ ਹੈ ਜਿਵੇਂ ਜੀਓ ਆਈ ਹੈ ਸਿਮ ਅੰਬਾਨੀ ਅਡਾਨੀ ਦਾ ਸਾਨੂੰ ਬਹੁਤ ਚੰਗੇ ਤਰੀਕੇ ਨਾਲ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਪੈਸੇ ਇਹਦੇ ਕੋਲ ਆ ਰਹੇ ਹਨ ਅਤੇ ਕਿੰਨੇ ਪੈਸੇ ਜਾ ਰਹੇ ਹਨ ਸਾਰੀਆਂ ਖਬਰਾਂ ਵਿੱਚ ਵਿਸ਼ਵਾਸ ਤਾਂ ਆਪਾਂ ਨਹੀਂ ਰੱਖਦੇ ਬਿਲਕੁਲ ਨਹੀਂ ਰੱਖਦੇ ਕਿਉਂਕਿ ਕਈ ਇਹਨਾਂ ਵਿੱਚ ਜੈਨੀਉਨ ਹਨ ਅਤੇ ਕਈ ਨਹੀਂ ਹਨ ਅਸੀਂ ਜੋ ਆਪਣੇ ਅੱਖੀਂ ਦੇਖਦੇ ਹਾਂ ਲਾਈਵ ਹੁੰਦਾ ਦੇਖਦੇ ਹਾਂ ਉਹੀ ਉਸ ਚੀਜ਼ 'ਤੇ ਆਪਾਂ ਵਿਸ਼ਵਾਸ ਕਰਦੇ ਹਾਂ ਜਾਂ ਸਾਨੂੰ ਲੱਗਦੀ ਹੈ ਹਰ ਇੱਕ ਬੰਦੇ 'ਚ ਇੰਨੀ ਸੈਂਸ ਤਾਂ ਹੁੰਦੀ ਹੈ ਕਿ ਉਹ ਜੱਜਮੈਂਟ ਕਰ ਸਕਦਾ ਹੈ ਕਿਸੇ ਵੀ ਚੀਜ਼ ਦੀ ਕਿ ਉਹ ਸਹੀ ਹੈ ਜਾਂ ਗਲਤ ਹੈ ਬਾਕੀ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਆਪਾਂ ਨਿਊਜ਼ ਚੈਨਲ ਨਾਲ ਨਿਊਜ ਚੈਨਲ ਵਾਲੇ ਨੂੰ ਵੀ ਨਹੀਂ ਕਹਿ ਸਕਦੇ ਆਪਾਂ ਇੱਦਾਂ ਸੋ ਆਪਾਂ ਇਹਨਾਂ 'ਤੇ ਵਿਸ਼ਵਾਸ ਰੱਖਦੇ ਵੀ ਹਾਂ ਅਤੇ ਨਹੀਂ ਵੀ ਰੱਖਦੇ ਹਾਂ ਪਰ ਪ੍ਰੈਸ ਵਾਲਿਆਂ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਸਾਨੂੰ ਮੀਡੀਆ ਨੂੰ ਜੈਨੀਉਨ ਖਬਰ ਦਿਖਾਈ ਜਾਵੇ ਕਿ ਜੋ ਕਿ ਸਹੀ ਹੈ ਵਧਾ ਚੜ੍ਹਾ ਕੇ ਗੱਲ ਨਾ ਦੱਸੀ ਜਾਵੇ